ਪੰਜਾਬ ਵਿੱਚ ਸਿਹਤ ਸਹੂਲਤਾਂ ਬਹੁਤ ਹੀ ਵਧੀਆ ਹਨ ਪੁਰਾਣੇ ਸਮੇਂ ਨਾਲੋਂ ਇਹਨਾਂ ਵਿੱਚ ਬਹੁਤ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਤਾਂ ਪਰ ਹੋਰ ਵੀ ਜ਼ਿਆਦਾ ਸੁਧਾਰ ਆਉਣਾ ਚਾਹੀਦਾ ਹੈ ਜਿਵੇਂ ਕਿ ਇੱਥੇ ਦਵਾਈਆਂ ਹਰ ਤਰ੍ਹਾਂ ਦੀਆਂ ਮਿਲਣੀਆਂ ਚਾਹੀਦੀਆਂ ਹਨ ਲੋਕਾਂ ਨੂੰ ਕੋਈ ਵੀ ਦਵਾਈ ਬਾਹਰੋਂ ਨਾ ਲੈਣੀ ਪਵੇ ਅਤੇ ਇੱਥੇ ਬਲੱਡ ਬੈਂਕ ਦੇ ਵਿੱਚ ਹਰ ਤ ਗਰੁੱਪ ਦਾ ਜੋ ਕਿ ਖੂਨ ਉਪਲੱਬਧ ਹੋਣਾ ਚਾਹੀਦਾ ਤਾਂ ਕਿ ਕਿਸੇ ਨੂੰ ਵੀ ਐਮਰਜੈਂਸੀ ਦੇ ਵਿੱਚ ਜ਼ਿਆਦਾ ਸਮਾਂ ਨਾ ਗਵਾਉਣਾ ਪਵੇ ਅਤੇ ਜਲਦੀ ਤੋਂ ਜਲਦੀ ਕਿਸੇ ਵੀ ਪਰਸਨ ਦਾ ਜੋ ਕੀ ਹੈ ਇਲਾਜ ਹੋ ਸਕੇ ਅਤੇ ਇੱਥੇ ਕੀ ਹੈ ਹਰ ਤਰ੍ਹਾਂ ਦੇ ਸਪੈਸ਼ਲੀਸਟ ਡਾਕਟਰ ਹੋਣੇ ਚਾਹੀਦੇ ਹਨ ਅਤੇ ਓ ਉਹ ਚੌਵੀ ਘੰਟੇ ਐਬੂਲੈਂਸ ਉਪਲੱਬਧ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਵੀ ਕਿਸੇ ਦੇ ਵੀ ਇਲਾਜ ਵਿੱਚ ਜੋ ਕੀ ਹੈ ਕੋਈ ਵੀ ਦੇਰੀ ਨਾ ਹੋਵੇ ਅਤੇ ਹਰ ਕਿਸੇ ਦਾ ਵੀ ਜੋ ਕਿ ਇਲਾਜ ਹੈ ਚੰਗੀ ਤਰ੍ਹਾਂ ਹੋ ਸਕੇ ਜੇ ਇੱਥੇ ਵਧੀਆ ਡਾਕਟਰ ਹੋਣਗੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਨਹੀਂ ਜਾਣਾ ਪਵੇਗਾ ਉਸ ਕੋਈ ਵੀ ਤ ਤਰ੍ਹਾਂ ਦੀ ਬਿਮਾਰੀ ਹੈ ਜੋ ਜਾਂ ਕੋਈ ਐਕਸੀਡੈਂਟ ਵਗੈਰਾ ਹੈ ਤਾਂ ਸਾਰਾ ਕੁਛ ਕੀ ਹੈ ਪੰਜਾਬ ਦੇ ਵਿੱਚ ਹੀ ਹੱਲ ਹੋ ਸਕਦਾ ਹੈ ਧੰਨਵਾਦ